ਸਾਡੇ ਰਾਜ ਪੰਜਾਬ ਦੀ ਭਾਸ਼ਾ ਪੰਜਾਬੀ ਹੈ ਪੰਜਾਬੀ ਵਿੱਚ ਸਾਡਾ ਲਿਟਰੇਚਰ ਹੈ ਪੰਜਾਬੀ ਵਿੱਚ ਹੀ ਸਾਡੀਆਂ ਕਿਤਾਬਾਂ ਲਿਖੀਆਂ ਗਈਆਂ ਹੈ ਜੋ ਕਿ ਬੱਚੇ ਬਚਪਨ ਤੋਂ ਲੈ ਕੇ ਪੜ੍ਹਦੇ ਹਨ ਬਚਪਨ ਤੋਂ ਹੀ ਸਾਡੀ ਮਾਂ ਬੋਲੀ ਪੰਜਾਬੀ ਨੂੰ ਤਰਜੀਬ ਦਿੱਤੀ ਜਾਂਦੀ ਹੈ ਹਰ ਸਕੂਲ ਦੇ ਵਿੱਚ ਪੰਜਾਬੀ ਪੜ੍ਹਨੀ ਲਾਜ਼ਮੀ ਹੈ ਸਾਡੇ ਗ੍ਰੰਥ ਗੁਰੂ ਸਾਹਿਬਾਂ ਨੇ ਜੋ ਲਿਖੇ ਹਨ ਉਹ ਵੀ ਪੰਜਾਬੀ ਵਿੱਚ ਹੀ ਹਨ ਪੰਜਾਬੀ ਦੇ ਵਿੱਚ ਹੀ ਸਾਡਾ ਗੀਤ ਸੰਗੀਤ ਹੈ ਸਾਡਾ ਸੰਗੀਤ ਸਾਡੇ ਗੀਤ ਜਿਹੜੇ ਆ ਪੰਜਾਬੀ ਦੇ ਵਿੱਚ ਜੋ ਕਿ ਬੋਲੀਵੁੱਡ ਤੱਕ ਚਲਦੇ ਹਨ ਅਤੇ ਸਾਰੀ ਦੁਨੀਆਂ ਦੇ ਵਿੱਚ ਇੱਕ ਪਹਿਚਾਣ ਦੀ ਤਰ੍ਹਾਂ ਹੈ ਸਾਡਾ ਲੋਕ ਨਾਚ ਪੰਜਾਬ ਦਾ ਗਿੱਧਾ ਭੰਗੜਾ ਇਹ ਪੰਜਾਬੀਆਂ ਦੀ ਪਹਿਚਾਣ ਹੈ ਸਾਡੇ ਸੱਭਿਆਚਾਰ ਦੀ ਪਹਿਚਾਣ ਹੈ ਅਤੇ ਸਾਡੇ ਗੀਤ ਸੰਗੀਤ ਸਾਡੀਆਂ ਕਵੀਸ਼ਰ ਗੁਰੂ ਗਾਥਾਵਾਂ ਸਾਡਾ ਜੋ ਵੀ ਹੈ ਉਹ ਪੰਜਾਬ ਦੇ ਵਿੱਚ ਪੰਜਾਬੀ ਨੂੰ ਹੀ ਤਰਜੀਬ ਦਿੰਦਾ ਹੈ ਅਤੇ ਪੰਜਾਬੀ ਦੇ ਵਿੱਚ ਹੀ ਲਿਖਿਆ ਜਾਂਦਾ ਹੈ ਅਤੇ ਪੜ੍ਹਿਆ ਜਾਂਦਾ ਹੈ ਸ਼ੁਕਰੀਆ